ਇੱਕ ਅਗਸਤ ਦੋ ਹਜ਼ਾਰ ਚੌਵੀ ਦੋ ਅਗਸਤ ਦੋ ਹਜ਼ਾਰ ਚੌਵੀ ਪੰਜ ਅਗਸਤ ਦੋ ਹਜ਼ਾਰ ਚੌਵੀ ਸੱਤ ਅਗਸਤ ਦੋ ਹਜ਼ਾਰ ਚੌਵੀ ਅਤੇ ਦਸ ਦਸੰਬਰ ਦੋ ਹਜ਼ਾਰ ਚੌਵੀ